ਪੰਜਾਬੀ ਸਾਹਿਤ ਅਤੇ ਕਵਿਤਾ ਪੰਜਾਬੀ ਭਾਸ਼ਾ ਦੇ ਜਿਉਂਦੇ ਧਾਗਿਆਂ ਦੁਆਰਾ ਕੱਢੀ ਅਮੀਰ ਫੁਲਕਾਰੀ ਦਾ ਪ੍ਰਦਰਸ਼ਨ ਕਰਦੀ ਏ ਇੱਕ ਸੱਭਿਆਚਾਰਕ ਭਾਈਚਾਰੇ ਦੀਆਂ ਜੜ੍ਹਾਂ ਜੋ ਭਾਰਤ ਅਤੇ ਪਾਕਿਸਤਾਨ ਦੋਵਾਂ ਵਿੱਚ ਫੈਲੀਆਂ ਹੋਈਆਂ ਨੇ ਪੰਜਾਬੀ ਸਾਹਿਤ ਵਿੱਚ ਪਿਆਰ ਅਤੇ ਅਧਿਆਤਮਿਕਤਾ ਤੋਂ ਲੈ ਕੇ ਸਮਾਜਿਕ ਮੁੱਦਿਆਂ ਅਤੇ ਇਤਿਹਾਸਿਕ ਬਿਰਤਾਂਤਾਂ ਤੱਕ ਵਿਸ਼ਿਆਂ ਦੀ ਵਿਭਿੰਨ ਸ਼੍ਰੇਣੀਆਂ ਵਿੱਚ ਸ਼ਾਮਿਲ ਹੋ ਰਹੀਆਂ ਨੇ ਕਵਿਤਾ ਵਿੱਚ ਪੰਜਾਬੀ ਦੀ ਗੀਤਕਾਰੀ ਜਿਉਂਦੀ ਦਿਸਦੀ ਏ ਕਹਿ ਸਕਦੇ ਹਾਂ ਕਿ ਕਵਿਤਾਵਾਂ ਦੁਆਰਾ ਗੀਤਕਾਰੀ ਨੱਚਦੀ ਏ ਜੋ ਅਕਸਰ ਧਰਤੀ 'ਤੇ ਉਸਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੀ ਏ ਕਵਿਤਾ ਦੀ ਤਾਲ ਸੁਰੀਲੀ ਜੋ ਬੋਲਣ ਵਾਲਿਆਂ ਦੀਆਂ ਭਾਵਨਾ ਅਤੇ ਅਨੁਭਵਾਂ ਵਿੱਚ ਇਕ ਵਿਲੱਖਣ ਸ਼ੈਅ ਪ੍ਰਦਾਨ ਕਰਦੀ ਹੈ ਪੰਜਾਬੀ ਕਵਿਤਾ ਦਾ ਇੱਕ ਮਹੱਤਵਪੂਰਨ ਰੂਪ ਹੈ ਕਿੱਸਾ ਇਹ ਇੱਕ ਬਿਰਤਾਂਤਕ ਰੂਪ ਹੈ ਜੋ ਕਾਵ ਤੱਤਾਂ ਨਾਲ ਕਹਾਣੀ ਸੁਣਾਉਂਦਾ ਹੈ ਬਹਾਦਰੀ ਪਿਆਰ ਦੁਖਾਂਤ ਦੀਆਂ ਕਹਾਣੀਆਂ ਅਤੇ ਭਾਵਨਾਵਾਂ ਨੂੰ ਬਿਆਨ ਕਰਦਾ ਹੈ ਜੋ ਕਿ ਪੀੜ੍ਹੀ ਪੀੜ੍ਹੀਆਂ ਤੋਂ ਲੰਘੀ ਮੌਖਿਕ ਪਰੰਪਰਾ ਨੂੰ ਦਰਸਾਉਂਦੇ ਨੇ ਪੰਜਾਬੀ ਲਿਪੀ ਗੁਰਮੁਖੀ ਸਾਹਿਤਕ ਵਿਰਸੇ ਨੂੰ ਸੰਭਾਲਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਇਹ ਨਾ ਸਿਰਫ ਲਿਖਤੀ ਰੂਪ ਸਗੋਂ ਸੱਭਿਆਚਾਰਕ ਮਹੱਤਵ ਵੀ ਰੱਖਦੀ ਏ ਜੋ ਪੰਜਾਬੀ ਬੋਲਣ ਵਾਲੇ ਭਾਈਚਾਰੇ ਦੀ ਪਛਾਣ ਏ ਇਸ ਤੋਂ ਇਲਾਵਾ ਪੰਜਾਬੀ ਸਾਹਿਤ ਸਮਕਾਲੀ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਸ਼ਕਤੀਸ਼ਾਲੀ ਸਾਧਨ ਵਜੋਂ ਸੇਵਾ ਕਰਦਾ ਹੈ ਲੇਖਕ ਅਤੇ ਕਵੀ ਆਧੁਨਿਕ ਜੀਵਨ ਦੀਆਂ ਗੁੰਝਲਾਂ ਨੂੰ ਬਿਆਨ ਕਰਨ ਲਈ ਆਪਣੀ ਕਲਾ ਦੀ ਵਰਤੋਂ ਕਰਦੇ ਨੇ ਪ੍ਰਵਾਸੀ ਪਛਾਨ ਅਤੇ ਸਮਾਜਿਕ ਤਬਦੀਲੀ ਵਰਗੇ ਵਿਸ਼ਿਆਂ ਦੀ ਖੋਜ ਕਰਦੇ ਅਜੋਕੇ ਸਮੇਂ ਦੀਆਂ ਚੁਣੌਤੀਆਂ ਅਤੇ ਮੌਕਿਆਂ ਨੂੰ ਗਲੇ ਲਗਾਉਂਦੇ ਹੋਏ ਪਰੰਪਰਾ ਨੂੰ ਅਪਣਾਉਂਦੇ ਪੰਜਾਬੀ ਸਾਹਿਤ ਵਿਕਸਿਤ ਹੋ ਰਿਹਾ ਏ ਸਿੱਟੇ ਵਜੋਂ ਪੰਜਾਬੀ ਸਾਹਿਤ ਅਤੇ ਕਵਿਤਾ ਕਿਸੇ ਭਾਈਚਾਰੇ ਦੀ ਰੂਹ ਵਿੱਚ ਹਵਾ ਦਾ ਕੰਮ ਕਰਦੀ ਏ ਜੋ ਇਸ ਦੀਆਂ ਇਤਿਹਾਸਿਕ ਕਦਰਾਂ ਕੀਮਤਾਂ ਅਤੇ ਇੱਛਾਵਾਂ ਨੂੰ ਦਰਸਾਉਂਦੀ ਹੈ